ਸਤਿ ਸ਼੍ਰੀ ਅਕਾਲ ਸਰ ਬਰਾੜ ਰੈਸਟੋਰੈਂਟ ਤੋਂ ਗੱਲ ਕਰ ਰਹੇ ਜੀ ਸਰ ਸੰਦੀਪ ਗੱਲ ਕਰ ਰਿਹਾ ਝੁੰਬੇ ਤੋਂ ਆਪਣੇ ਨਾ ਇੱਕ ਸ਼ਾਮ ਦਾ ਪ੍ਰੋਗਰਾਮ ਆ ਜੀ ਪਾਰਟੀ ਆ ਛੋਟੀ ਜਿਹੀ ਚਾਲੀ ਕੁ ਬੰਦਿਆਂ ਦੀ ਅਤੇ ਰੋਟੀ ਦਾ ਸ਼ਾਮ ਦੀ ਦਾ ਪ੍ਰਬੰਧ ਕਰਕੇ ਦਿਓ ਸਰ ਸ਼ਾਮ ਦੀ ਦਾ ਆਪਾਂ ਨੂੰ ਚਾਲੀ ਬੰਦਿਆਂ ਦੀ ਰੋਟੀ ਚਾਹੀਦੀ ਹੈ ਅਤੇ ਉਸ ਦੇ ਵਿੱਚ ਕੀ ਕੁਛ ਸਾਨੂੰ ਤੁਸੀਂ ਦੇ ਸਕਦੇ ਹੋ ਜਾਣੀ ਕਿ ਇੱਕ ਤਾਂ ਸ਼ਾਹੀ ਪਨੀਰ ਜਾਂ ਕੜਾਹੀ ਪਨੀਰ ਦੋਨਾਂ 'ਚੋਂ ਇੱਕ ਕਰ ਦਿਓ ਬਾਕੀ ਦੋ ਸੁੱਕੀਆਂ ਸਬਜ਼ੀਆਂ ਹੋਰ ਕਰ ਦਿਓ ਹੈ ਨਾ ਜੀ ਅਤੇ ਇਸ ਦੇ ਨਾਲ ਨਾਲ ਕੋਈ ਮਿੱਠੇ ਦੇ ਵਿੱਚ ਆਈਸ ਕ੍ਰੀਮ ਵਗੈਰਾ ਜਾਂ ਕੋਈ ਹੋਰ ਚੀਜ਼ ਆਈਸ ਕ੍ਰੀਮ ਹੀ ਕਰ ਦਿਓ ਸਰ ਆਈਸ ਕ੍ਰੀਮ ਠੀਕ ਰਹੇਗੀ ਹੈ ਨਾ ਜੀ ਅਤੇ ਮੈਂ ਟਾਈਮਿੰਗ ਤੁਹਾਨੂੰ ਦੱਸ ਦਿੰਦਾ ਵੀ ਕੀ ਟਾਈਮ ਸ਼ਾਮ ਨੂੰ ਪਹੁੰਚਾਉਣਾ ਗਾ ਉਸ ਦੇ ਵਿੱਚ ਰੋਟੀਆਂ ਦੇ ਵਿੱਚ ਤੰਦੂਰੀ ਰੋਟੀ ਅਤੇ ਤਵੇ ਵਾਲੀ ਰੋਟੀ ਵੀ ਕਰ ਦਿਓ ਹੈ ਨਾ ਜੀ ਅਤੇ ਨਾਲ ਕੋਈ ਨਾਨ ਵਗੈਰਾ ਇਸ ਤਰ੍ਹਾਂ ਦੇ ਹੈ ਨਾ ਔਡਰ ਵੱਖ ਵੱਖ ਉਹ ਕਰ ਦਿਓ ਵੀ ਹਾਂਜੀ ਅਤੇ ਇਸ ਦਾ ਸਾਨੂੰ ਜਿਹੜਾ ਕਿ ਤੁਹਾਡਾ ਪ੍ਰਾਈਜ਼ ਹੈਗਾ ਥੋੜ੍ਹਾ ਜਿਹਾ ਵੀ ਸਾਨੂੰ ਡਿਸਕਾਊਂਟ ਦਿਓ ਇਹਦੇ ਵਿੱਚ ਕੁਛ ਨਾ ਕੁਛ ਦਸ ਪਰਸੈਂਟ ਜਾਂ ਕੁਛ ਵੀ ਹੈ ਨਾ ਕਿਉਂਕਿ ਐਡਾ ਵੱਡਾ ਤੁਹਾਨੂੰ ਔਡਰ ਦੇ ਰਹੇ ਹਾਂ ਅਸੀਂ ਹੈ ਨਾ ਜੀ ਅਤੇ ਇਸ ਕਰਕੇ ਅੱਗੇ ਵੀ ਤੁਹਾਡੇ ਤੋਂ ਹੀ ਆਉਂਦਾ ਸਰ ਅਤੇ ਟਾਈਮ 'ਤੇ ਸਾਨੂੰ ਥੋੜ੍ਹਾ ਜਿਹਾ ਪਹੁੰਚਾ ਦਿਓ ਟਾਈਮਿੰਗ ਮੈਂ ਸ਼ਾਮ ਦੀ ਦੱਸ ਦਿੰਦਾ ਓਕੇ ਸਰ ਅਤੇ ਇਸ ਨੰਬਰ ਤੋਂ ਬੈਕ ਕੌਲ ਕਰਦਾ ਜੀ ਮੈਂ ਤੁਹਾਨੂੰ ਅਤੇ ਧੰਨਵਾਦ ਜੀ